ਬੰਦੀ ਛੋੋੜ ਜੋ ਦਿਵਸ ਹੈ ਉਹ ਅੱਸੂ ਦੇ ਮਹੀਨੇ ਮਨਾਇਆ ਜਾਂਦਾ ਹੈ ਅਤੇ ਸਿੱਖਾਂ ਵਿੱਚ ਇਸ ਦੀ ਅਲੱਗ ਹੀ ਮਤਲਬ ਮਾਨਸਿਕ ਤੌਰ 'ਤੇ ਬੰਦੀ ਛੋੜ ਦਿਵਸ ਨਾਲ ਜੁੜੇ ਹੋਏ ਹਨ ਇਸ ਵਿੱਚ ਇੱਦਾਂ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਨੇ ਮੀਰੀ ਪੀਰੀ ਦੀ ਤਲਵਾਰ ਧਾਰਨ ਕੀਤੀ ਸੀ ਅਤੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਜਦੋਂ ਕੈਦ ਕਰ ਲਿਆ ਗਿਆ ਸੀ ਤਾਂ ਉਦੋਂ ਉਹਨਾਂ ਨੇ ਮਤਲਬ ਇਕੱਲੇ ਰਿਹਾਅ ਹੋਣ ਤੋਂ ਇੰਨਕਾਰ ਕਰ ਦਿੱਤਾ ਸੀ ਅਤੇ ਉਹਨਾਂ ਨੇ ਬਵੰਜਾ ਰਾਜਿਆਂ ਨੂੰ ਛੁਡਵਾ ਕੇ ਲਿਆਂਦਾ ਸੀ ਪਰ ਇਸ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਆ ਉਹ ਇੱਦਾਂ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਪੰਜਵੇਂ ਪਾਤਸ਼ਾਹ ਉਹਨਾਂ ਦੀ ਜਦੋਂ ਸ਼ਾਂਤਮਈ ਸ਼ਹਾਦਤ ਹੋਈ ਤਾਂ ਉਹਨਾਂ ਦੀ ਸ਼ਹਾਦਤ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ ਅਤੇ ਉਸ ਤੋਂ ਬਾਅਦ ਕੀ ਸੀ ਕਿ ਜੋ ਸਿੱਖ ਸੀਗੇ ਪੰਜਾਬ ਦੇ ਜਿਹੜੇ ਲੋਕ ਸੀ ਉਹ ਜਾਗਰੂਕ ਹੋ ਗਏ ਅਤੇ ਜਹਾਂਗੀਰ ਦੇ ਖਿਲਾਫ ਖੜ੍ਹੇ ਹੋ ਗਏ ਅਤੇ ਜਹਾਂਗੀਰ ਨੂੰ ਇੱਦਾਂ ਲੱਗਦਾ ਸੀ ਕਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਹਨਾਂ ਨੂੰ ਮਤਲਬ ਭੜਕਾ ਰਹੇ ਨੇ ਲੋਕਾਂ ਨੂੰ ਇਸ ਲਈ ਉਹਨਾਂ ਨੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਸਾਹਿਬ ਨੂੰ ਕੈਦੀ ਬਣਾ ਲਿਆ ਪਰ ਉਹਨਾਂ ਨੂੰ ਕੈਦੀ ਬਣਾਉਣ ਤੋਂ ਬਾਅਦ ਹੀ ਉਹਨੂੰ ਜਹਾਂਗੀਰ ਦੀ ਜਿਹੜੀ ਤਬੀਅਤ ਸੀ ਉਹ ਜ਼ਿਆਦਾ ਖਰਾਬ ਹੋਣ ਲੱਗ ਗਈ ਅਤੇ ਉਹਨਾਂ ਦੀ ਕਾਜ਼ੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਗੁਰੂ ਨੂੰ ਕੈਦ ਕੀਤਾ ਹੈ ਅਤੇ ਇਸ ਲਈ ਮਤਲਬ ਤੁਹਾਡੀ ਮਤਲਬ ਸਿਹਤ ਠੀਕ ਨਹੀਂ ਰਹਿੰਦੀ ਇਸ ਲਈ ਉਹਨਾਂ ਨੇ ਉਹਨਾਂ ਨੂੰ ਰਿਹਾਅ ਕਰਨ ਲਈ ਬੋਲ ਦਿੱਤਾ ਪਰ ਸ਼੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਕਹਿੰਦੇ ਵੀ ਅਸੀਂ ਇਕੱਲੇ ਰਿਹਾਅ ਨਹੀਂ ਹੋਵਾਂਗੇ ਜੋ ਗਵਾਲੀਅਰ ਦੇ ਕਿਲ੍ਹੇ ਵਿੱਚ ਹੋਰ ਬਵੰਜਾ ਰਾਜੇ ਨੇ ਉਹ ਸਾਡੇ ਸਮੇਤ ਹੀ ਰਿਹਾਅ ਹੋਣਗੇ ਪਰ ਜਹਾਂਗੀਰ ਇਹ ਨਹੀਂ ਸੀ ਚਾਹੁੰਦਾ ਪਰ ਗੁਰੂ ਜੀ ਨੇ ਇਕੱਲੇ ਰਿਹਾਅ ਹੋਣ ਤੋਂ ਮਤਲਬ ਇੰਨਕਾਰ ਕਰ ਦਿੱਤਾ ਪਰ ਜਹਾਂਗੀਰ ਨੂੰ ਮਤਲਬ ਉਹਨਾਂ ਦੀ ਜਿੱਦ ਅੱਗੇ ਝੁਕਣਾ ਪਿਆ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬਵੰਜਾ ਰਾਜਿਆ ਨੂੰ ਰਿਹਾਅ ਕਰ ਦੇਵਾਂਗੇ ਪਰ ਜੋ ਜਹਾਂਗੀਰ ਸੀ ਉਹਨੇ ਵੀ ਇੱਕ ਸ਼ਰਤ ਰੱਖੀ ਕਿ ਜਿਹੜੇ ਬਵੰਜੇ ਰਾਜੇ ਨੇ ਉਹ ਗੁਰੂ ਦੇ ਅੰਗ ਨਾਲ ਮਤਲਬ ਜਿਹਨੇ ਅੰਗ ਨੂੰ ਛੂਹਿਆ ਉਹ ਹੀ ਬਾਹਰ ਆ ਸਕਦਾ ਪਰ ਉਹ ਵੀ ਬਵੰਜਾ ਦੇ ਬਵੰਜਾ ਰਾਜੇ ਤਾਂ ਗੁਰੂ ਜੀ ਨੂੰ ਛੂਹ ਨਹੀਂ ਸਕਦੇ ਪਰ ਗੁਰੂ ਜੀ ਨੇ ਕੀ ਕੀਤਾ ਉਹਨਾਂ ਨੇ ਮਤਲਬ ਇੱਕ ਇਹੋ ਅਜਿਹਾ ਕੁੜਤਾ ਸਵਾਇਆ ਜਿਹਦੇ ਬਵੰਜਾ ਕਲੀਆਂ ਰਖਵਾ ਦਿੱਤੀਆਂ ਅਤੇ ਹਰ ਇੱਕ ਰਾਜਾ ਉਹ ਇੱਕ ਇੱਕ ਕਲੀ ਨੂੰ ਫੜ ਕੇ ਬਾਹਰ ਆ ਗਿਆ ਅਤੇ ਇਸ ਤਰ੍ਹਾਂ ਬਵੰਜਾ ਦੇ ਬਵੰਜਾ ਰਾਜੇ ਰਿਹਾਅ ਹੋ ਗਏ ਅਤੇ ਉਸ ਦਿਨ ਇਹ ਸੀ ਕਿ ਦੀਵਾਲੀ ਦਾ ਦਿਨ ਸੀ ਜਿਸ ਦਿਨ ਉਹ ਰਿਹਾਅ ਹੋਏ ਸੀ ਇਸ ਲਈ ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਵਾਪਿਸ ਆਏ ਤਾਂ ਜੋ ਸਿੱਖਾਂ ਨੇ ਉਹਨਾਂ ਨੇ ਦੇਸੀ ਘਿਓ ਦੇ ਦੀਵੇ ਮਤਲਬ ਲਗਾਏ ਕਿ ਉਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਇਸ ਲਈ ਸਿੱਖਾਂ ਵਿੱਚ ਇਸ ਦੀ ਬਹੁਤ ਮਹੱਤਤਾ ਹੈ ਇਹ ਦਿਵਸ ਮਤਲਬ ਬਹੁਤ ਧੂਮ ਧਾਮ ਨਾਲ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਹੈ